ਮੈਨੂੰ ਚੀਜ਼ਾਂ ਖਰੀਦਣ ਦਾ ਬਹੁਤ ਸ਼ੌਕ ਹੈ ਮੈਂ ਹਮੇਸ਼ਾ ਹੀ ਔਨਲਾਈਨ ਸ਼ਾਪਿੰਗ ਕਰਦੀ ਹਾਂ ਇੱਕ ਦਿਨ ਮੈਂ ਆਰਡਰ ਕੀਤਾ ਇੱਕ ਹੈਂਡ ਬੈਗ ਲਈ ਔਡਰ ਕੀਤਾ ਮੈਨੂੰ ਹੈਂਡ ਬੈਗ ਬਹੁਤ ਹੀ ਵਧੀਆ ਲੱਗਿਆ ਇਸ ਕਰਕੇ ਮੈਂ ਉਹਨੂੰ ਆਰਡਰ ਕਰ ਦਿੱਤਾ ਔਨਲਾਈਨ ਆਰਡਰ ਕੀਤਾ ਮੈਂ ਫਲਿਪਕਾਰਟ 'ਤੇ ਆਰਡਰ ਕੀਤਾ ਫਲਿਪਕਾਰਟ ਵਾਲਿਆਂ ਨੇ ਆਰਡਰ ਮੇਰਾ ਪਲੇਸ ਕਰ ਲਿਆ ਬਹੁਤ ਹੀ ਵਧੀਆ ਤਰੀਕੇ ਨਾਲ ਉਹਨਾਂ ਨੇ ਮੈਨੂੰ ਡੀਲ ਕੀਤਾ ਉਹਨਾਂ ਦਾ ਬੰਦਾ ਆਇਆ ਇੱਕ ਦਿਨ ਚਾਰ ਪੰਜ ਦਿਨ ਬਾਅਦ ਮੇਰਾ ਆਰਡਰ ਪਲੇਸ ਹੋਇਆ ਉਹਨਾਂ ਦਾ ਫਲਿਪ ਕਾਰਟ ਵਾਲਿਆਂ ਵੱਲੋਂ ਬੰਦਾ ਬੰਦੇ ਨੇ ਮੈਨੂੰ ਐਡਰੈੱਸ ਪੁੱਛਿਆ ਆ ਕੇ ਪੁੱਛਿਆ ਮੈਨੂੰ ਮੈਂ ਉਹਨਾਂ ਨੂੰ ਆਪਣੀ ਕਲੋਨੀ ਦਾ ਐਡਰੈਸ ਸਮਝਾਇਆ ਉਹ ਬੜੀ ਜਲਦੀ ਨਾਲ ਮੇਰੇ ਘਰ ਪਹੁੰਚ ਗਿਆ ਉਹਨੇ ਮੈਨੂੰ ਬੜੇ ਸੋਹਣੇ ਤਰੀਕੇ ਨਾਲ ਮੈਨੂੰ ਡਿਲੀਵਰ ਕੀਤਾ ਮੈਂ ਕੈਸ਼ ਔਨ ਕੈਸ਼ ਔਨ ਪੇ ਕੈਸ਼ ਔਨ ਡਿਲੀਵਰੀ ਕੀਤਾ ਸੀ ਔਰ ਮੈਨੂੰ ਮੈਂ ਬੈਗ ਖੋਲ੍ਹ ਕੇ ਦੇਖਿਆ ਬੈਅ ਬਹੁਤ ਹੀ ਸੋਹਣਾ ਸੀ ਮੈਂ ਇੱਕ ਪਿੰਕ ਰੰਗ ਦਾ ਬੈਅ ਆਰਡਰ ਕੀਤਾ ਸੀ ਜਦੋਂ ਮੈਂ ਬੈਕ ਖੋਲ੍ਹ ਕੇ ਦੇਖਿਆ ਅਤੇ ਬਹੁਤ ਹੀ ਵਧੀਆ ਸੀ ਮੈਨੂੰ ਉਹਦਾ ਉਹਨਾਂ ਦੀ ਫਲਿਪਕਾਡ ਵਾਲਿਆਂ ਦਾ ਡਿਲੀਵਰੀ ਕਰਨ ਦਾ ਢੰਗ ਬਹੁਤ ਹੀ ਵਧੀਆ ਲੱਗਾ ਇਸ ਕਰਕੇ ਮੈਨੂੰ ਮੈਂ ਉਹਨਾਂ ਨੂੰ ਪੁੱਛਿਆ ਉਹਨਾਂ ਨੇ ਜਿਹੜਾ ਮੈਨੂੰ ਬੰਦਾ ਦੇਣ ਆਇਆ ਸੀਗਾ ਆਰਡਰ ਦੇਣ ਆਇਆ ਸੀ ਉਹਨੇ ਪੁੱਛਿਆ ਕਿ ਮੈਮ ਜੇ ਤੁਹਾਨੂੰ ਨਹੀਂ ਪਸੰਦ ਜਾਂ ਜਦੋਂ ਤੁਸੀਂ ਦੇਖ ਲਓ ਜੇ ਤੁਹਾਨੂੰ ਠੀਕ ਲੱਗੇਗਾ ਤੁਸੀਂ ਰੱਖ ਲਿਓ ਨਹੀਂ ਤਾਂ ਮੈਂ ਵਾਪਸ ਲੈ ਜਾਵਾਂਗਾ ਰਿਪਲੇਸ ਕਰਦਾਂਗਾ ਮਤਲਬ ਉਹਨਾਂ ਦਾ ਡਿਲੀਵਰੀ ਕਰਨ ਦਾ ਢੰਗ ਬਹੁਤ ਹੀ ਵਧੀਆ ਹੈ ਜਿਸ ਕਰਕੇ ਮੈਂ ਸਾਰਿਆਂ ਨੂੰ ਇਹੀ ਤੁਹਾਨੂੰ ਸਜੈਸਟ ਮਤਲਬ ਦੱਸਾਂਗੀ ਕਹਾਂਗੀ ਕਿ ਤੁਸੀਂ ਹਮੇਸ਼ਾ ਫਲਿਪਕਾਰਟ ਤੋਂ ਹੀ ਆਰਡਰ ਕਰਿਆ ਕਰੋ ਕਿਉਂਕਿ ਉਹਨਾਂ ਦੀ ਡਿਲੀਵਰੀ ਉਹਨਾਂ ਦੀ ਉਹਨਾਂ ਦੇ ਪ੍ਰੋਡਕਸ ਬਹੁਤ ਹੀ ਵਧੀਆ ਹਨ ਮੈਂ ਹੋਰ ਵੀ ਫਲਿਪਕਾਰਟ ਤੋਂ ਆਰਡਰ ਕਰਨਾ ਚਾਹੁੰਦੇ ਹਾਂ ਉਹਨੇ ਉਸ ਬਾਰੇ ਵੀ ਮੈਨੂੰ ਜਾਣਕਾਰੀ ਦਿੱਤੀ ਕਿ ਤੁਸੀਂ ਜੋ ਜੋ ਜੋ ਜਿਸ ਤਰ੍ਹਾਂ ਖਰੀਦਣਾ ਤੁਹਾਨੂੰ ਬਹੁਤ ਹੀ ਜਲਦੀ ਨਾਲ ਤੁਹਾਡਾ ਆਰਡਰ ਪਲੇਸ ਕਰ ਦਿੱਤਾ ਜਾਵੇਗਾ ਧੰਨਵਾਦ